ਕੱਲ੍ਹ ਮੈਂ ਆਪਣੇ ਸ਼ਹਿਰ ਤੋਂ ਚੰਡੀਗੜ੍ਹ ਲਈ ਇੱਕ ਕੈਬ ਬੁੱਕ ਕੀਤੀ ਕੈਬ ਦਾ ਡਰਾਈਵਰ ਸਮੇਂ ਸਿਰ ਮੇਰੇ ਦੱਸੇ ਪਤੇ 'ਤੇ ਪਹੁੰਚ ਗਿਆ ਅਤੇ ਜਦੋਂ ਅਸੀਂ ਰਸਤੇ ਵਿੱਚ ਜਾ ਰਹੇ ਸੀ ਤਾਂ ਉਸ ਨੇ ਮੇਰੇ ਨਾਲ਼ ਕਈ ਆਪਣਾ ਐਕਪੀਰੀਅਂਸ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਉਸਦੇ ਨਾਲ਼ ਜੀਵਨ ਵਿੱਚ ਜੋ ਜੋ ਵਰਤਿਆ ਹੈ ਉਹ ਉਸਨੇ ਮੈਨੂੰ ਆਪਣਾ ਸਭ ਕੁੱਝ ਦੱਸਿਆ ਜਿਸ ਕਰਕੇ ਮੈਨੂੰ ਆਪਣੇ ਲੰਬੇ ਸਫ਼ਰ ਦਾ ਬਿਲਕੁੱਲ ਵੀ ਪਤਾ ਨਹੀਂ ਚੱਲਿਆ ਹਾਲਾਂਕਿ ਰਸਤੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਜਿਸ ਦੀ ਵਜ੍ਹਾ ਕਰਕੇ ਮੈਂ ਆਪਣੇ ਪ੍ਰੋਗਰਾਮ ਤੋਂ ਪ ਲੇਟ ਹੋ ਰਿਹਾ ਸੀ ਉਸਨੇ ਮੈਨੂੰ ਇੱਕ ਹੋਰ ਨਵੇਂ ਰਸਤੇ ਰਾਹੀਂ ਲੈ ਕੇ ਗਿਆ ਜੋ ਕਿ ਮੇਰੇ ਪਹਿਲੇ ਰਸਤੇ ਨਾਲੋਂ ਜ਼ਿਆਦਾ ਲੰਬਾ ਸੀ ਪਰ ਉਸ ਨੇ ਮੈਨੂੰ ਮੇਰੇ ਤੋਂ ਇਸਦਾ ਕੋਈ ਜ਼ਿਆਦਾ ਪੈਸੇ ਨਹੀਂ ਲਿੱਤੇ ਮੈਨੂੰ ਉਸ ਨਾਲ਼ ਸਫ਼ਰ ਕਰਕੇ ਬਹੁਤ ਵਧੀਆ ਲੱਗਿਆ ਅਤੇ ਮੈਂ ਉਸ ਦਾ ਦਿਲੋਂ ਧੰਨਵਾਦ ਕਰਦਾ ਹਾਂ